ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਤਕਨੀਕੀ ਸਾਧਨ ਅਤੇ ਸਰੋਤਾਂ ਦਾ ਉਪਯੋਗ ਜ਼ਰੂਰੀ ਆ ਜਿੱਦਾਂ ਕਿ ਕਾਰਜ ਕਾਰ ਕਾਰਾਂ ਦਾ ਉਪਯੋਗ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ ਪਹਿਲਾਂ ਜਮਾਨੇ ਦੇ ਵਿੱਚ ਜਦੋਂ ਅਸੀਂ ਵੇਖਦੇ ਸੀ ਤਾਂ ਲੋਕ ਕਾਫੀ ਕਾਫੀ ਕਿਲੋਮੀਟਰ ਇੱਕ ਤੋਂ ਲੈ ਕੇ ਦੂਜੇ ਪਿੰਡ ਤੱਕ ਤੁਰ ਕੇ ਜਾਂਦੇ ਸੀ ਪੈਦਲ ਜਾਂਦੇ ਸੀ ਜਾਂ ਸਾਈਕਲ ਹੁੰਦੇ ਸੀ ਇਹਨਾਂ ਤੋਂ ਬਿਨਾਂ ਮਤਲਵ ਕਿ ਇਹਨਾਂ ਨਾਲ ਸਫਰ ਤਹਿ ਕਰਨਾ ਵੀ ਬਹੁਤ ਔਖਾ ਹੁੰਦਾ ਸੀ ਕਈ ਵਾਰ ਤਾਂ ਮਤਲਬ ਇੱਕ ਤੋਂ ਇੱਕ ਪਿੰਡ ਤੋਂ ਲੈ ਕੇ ਦੂਜੇ ਪਿੰਡ ਜਾਣ ਤੱਕ ਸਵੇਰ ਤੋਂ ਲੈ ਕੇ ਅਗਲਾ ਅ ਦਿਨ ਵੀ ਹੋ ਜਾਂਦਾ ਸੀਗਾ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਵੇਖਿਆ ਜਾਈਏ ਤਾਂ ਜੇ ਆਪਣੇ ਕੋਲ ਕਾਰ ਤਾਂ ਆਪਾਂ ਇੱਕ ਤੋਂ ਲੈ ਕੇ ਦੂਜੇ ਪਿੰਡ ਤੱਕ ਵੱਧ ਤੋਂ ਵੱਧ ਘੰਟਾ ਜਾਂ ਦੋ ਘੰਟਿਆਂ ਦੇ ਅੰਦਰ ਸਫ਼ਰ ਤਹਿ ਕਰ ਸਕਦੇ ਹਾਂ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸੁੱਖ ਹੈ ਕਿਉਂਕਿ ਅਸੀਂ ਆਉਣਾ ਜਾਣਾ ਇਸ ਲਈ ਹੁੰਦਾ ਹੈ ਕਿਉਂਕਿ ਜੇ ਆਪਾਂ ਨੂੰ ਕਿਤੇ ਸੁੱਖ ਦੇ ਪ੍ਰੋਗਰਾਮ ਦੇ ਵਿੱਚ ਜਾਂ ਖੁਸ਼ੀ ਦੇ ਗਮੀ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣਾ ਹੋਵੇ ਤਾਂ ਅਸੀਂ ਆਪਣਾ ਟਾਈਮ ਸਿਰ ਪਹੁੰਚ ਸਕਦੇ ਹਾਂ ਕਾਰਾਂ ਦਾ ਸਾਨੂੰ ਇਹ ਬੈਨੀਫਿਟ ਹੈ ਕਿ ਅਸੀਂ ਟਾਈਮ ਸਿਰ ਕਿਤੇ ਵੀ ਜਾ ਆ ਸਕਦੇ ਹਾਂ ਜੇ ਦੇਖਿਆ ਜਾਵੇ ਤਾਂ ਵਾਸ਼ਿੰਗ ਮਸ਼ੀਨਸ ਵੀ ਸਾਡੇ ਲਈ ਬਹੁਤ ਉਪਯੋਗੀ ਨੇ ਵਾਸ਼ਿੰਗ ਮਸ਼ੀਨਸ ਪਹਿਲਾਂ ਬੁੜੀਆਂ ਔਰ ਅਹ ਸੀਗੀਆਂ ਉਹ ਹੱਥਾਂ ਨਾਲ ਕੱਪੜੇ ਧੋਂਦੀਆਂ ਸੀ ਜਾਂ ਮੋਸਟਲੀ ਟੋਬਿਆਂ 'ਤੇ ਜਾ ਕੇ ਕੱਪੜੇ ਧੋਂਦੀਆਂ ਸੀਗੀਆਂ ਅਤੇ ਮਤਲਬ ਕਿ ਸੁਕਦੇ ਨਹੀਂ ਸੀਗੇ ਜ਼ਿਆਦਾ ਜ਼ਿਆਦਾ ਟਾਈਮ ਸੁਆ ਸੁਕਾਏ ਪੈਂਦੇ ਸੀਗੇ ਬਟ ਜਦੋਂ ਦੀਆਂ ਵਾਸ਼ਿੰਗ ਮਸ਼ੀਨਾਂ ਆਈਆਂ ਨੇ ਉਸ ਦੇ ਉਹ ਲੈ ਕੇ ਬੁੜੀਆਂ ਦਾ ਹੱਥਾਂ ਦਾ ਕੰਮ ਨਿਬੜ ਚੁੱਕਿਆ ਇਹ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਵਧੀਆ ਵਾਸ਼ ਕੀਤੇ ਜਾਂਦੇ ਨੇ ਸੁਕਾਏ ਵੀ ਜਾਂਦੇ ਨੇ ਕਈ ਕਈ ਵਾਰ ਜੇ ਮੀਂਹ ਦ ਦੀ ਆਪਣੇ ਮੀਂਹ ਵੀ ਆਉਂਦਾ ਹੈ ਤਾਂ ਮੀਂਹ ਦੇ ਦਿਨਾਂ ਦੇ ਵਿੱਚ ਵੀ ਇਹ ਪ੍ਰੋਬਲਮ ਆਪਣੇ ਲਈ ਸੌਖੀ ਸੋਲਵ ਹੋ ਜਾਂਦੀ ਹੈ ਕਿਉਂਕਿ ਆਪਾਂ ਕੱਪੜੇ ਵਿਓ ਵਾਸ਼ਿੰਗ ਮਸ਼ੀਨ ਦੇ ਵਿੱਚ ਸੁਕਾ ਕੇ ਆਪਣੇ ਅੰਦਰ ਵੀ ਸੁੱਕਣੇ ਪਾ ਸਕਦੇ ਹਾਂ ਜਿਸ ਨਾਲ ਕਿ ਕੱਪੜੇ ਸਾਨੂੰ ਜਲਦੀ ਸੁੱਕੇ ਮਿਲ ਜਾਂਦੇ ਨੇ ਜੇ ਦੇਖਿਆ ਜਾਵੇ ਤਾਂ ਟੈਲੀਵਿਜ਼ਨ ਟੈਲੀਵਿਜ਼ਨ ਪਹਿਲਾਂ ਵਾਲੇ ਜਮਾਨੇ ਦੇ ਵਿੱਚ ਓਨਲੀ ਬਲੈਕ ਐਂਡ ਵਾਈਟ ਹੀ ਹੁੰਦੇ ਸੀ ਉਹਨਾਂ ਦੇ ਵਿੱਚ ਮਤਲਬ ਬਹੁਤ ਘੱਟ ਕ ਲੋਕਾਂ ਦੇ ਘਰਾਂ ਵਿੱਚ ਟੀ ਵੀ ਹੁੰਦੇ ਸੀ ਪਹਿਲਾਂ ਦੇ ਜਮਾਨੇ ਦੇ ਵਿੱਚ ਪਰ ਹੁਣ ਅੱਜ ਕੱਲ੍ਹ ਤਾਂ ਇੱਕ ਲੋੜੀਂਦਾ ਬਣ ਚੁੱਕਿਆ ਹੈ ਟੀ ਵੀ ਦੀ ਜਗ੍ਹਾ 'ਤੇ ਹੁਣ ਐਲ ਈ ਡੀ ਵੀ ਆ ਚੁੱਕੀ ਆ ਪਹਿਲੀ ਗੱਲ ਤਾਂ ਅੱਜ ਜਮਾਨੇ ਦੇ ਵਿੱਚ ਦੇਖਿਆ ਜਾਵੇ ਤਾਂ ਬੱਚੇ ਬਹੁਤ ਜ਼ਿਆਦਾ ਟੀ ਵੀ ਵੇਖਦੇ ਨੇ ਜਿੱਦਾਂ ਕਿ ਕਾਰਟੂਨ ਵੇਖ ਲਈ ਫਿਲਮਾਂ ਵੇਖ ਲਈਆਂ ਇਹਨਾਂ ਨੂੰ ਬਹੁਤ ਜ਼ਿਆਦਾ ਤਵੱਜੋ ਦਿੰਦੇ ਨੇ ਤਾਂ ਇਸ ਕਰਕੇ ਅਸੀਂ ਦੇਖੀਏ ਤਾਂ ਟੀ ਵੀ ਵੀ ਇਕ ਸਾਡੇ ਜੀਵਨ ਦੇ ਵਿੱਚ ਮਹੱਤਵਪੂਰਨ ਸਾਧਨ ਆਇਆ ਹੈ ਇਹਦੂ ਬਾਅਦ ਅਸੀਂ ਗੱਲ ਕਰਦੇ ਹਾਂ ਮੋਬਾਈਲ ਫੋਨ ਦੀ ਜਿੱਦਾਂ ਕਿ ਮੋਬਾਈਲ ਫੋਨ ਬਿਨਾਂ ਅਸੀਂ ਅ ਇੱਕ ਦੂਜੇ ਨਾਲ ਗੱਲ ਕਰਨੀ ਪਹਿਲਾਂ ਦੇ ਜਮਾਨੇ ਦੇ ਵਿੱਚ ਜਿੱਦਾਂ ਕਿ ਚਿੱਠੀਆਂ ਰਾਹੀਂ ਇੱਕ ਦੂਜੇ ਨੂੰ ਸੱਦਾ ਪੱਤਰ ਦਿੱਤੇ ਜਾਂਦੇ ਸੀ ਚਿੱਠੀਆਂ ਰਾਹੀਂ ਕਬੂਤਰਾਂ ਰਾਹੀਂ ਭੇਜੇ ਜਾਂਦੇ ਸੀ ਤਾਂ ਉਹਨਾਂ ਨੂੰ ਕਾਫੀ ਕਾਫੀ ਦਿਨ ਕਾਫੀ ਕਾਫੀ ਮਹੀਨੇ ਲੱਗ ਜਾਂਦੇ ਸੀ ਜਿਸ ਕਰਕੇ ਮਤਲਬ ਸਾਨੂੰ ਵਾਪਸ ਸੁਨੇਹਾ ਆਉਣ ਤੋਂ ਬਹੁਤ ਟਾਈਮ ਲੱਗਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਸਾਡੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਤਾਂ ਅਸੀਂ ਕੋਈ ਵੀ ਖ਼ਬਰ ਕਿਸੇ ਤੱਕ ਵੀ ਵੱਧ ਤੋਂ ਵੱਧ ਪੰਜ ਜਾਂ ਦਸ ਮਿੰਟਾਂ ਤੱਕ ਪਹੁੰਚਾ ਸਕਦੇ ਹਾਂ ਜੇਕਰ ਮਤਲਬ ਸਾਡਾ ਕੋਈ ਦੂਰ ਦੁਰਾਡੇ ਦਾ ਰਿਸ਼ਤੇਦਾਰ ਹੈ ਵੱਧ ਤੋਂ ਵੱਧ ਦੇਸ਼ ਜਾਂ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤਾਂ ਅਸੀਂ ਉਹਨਾਂ ਨਾਲ ਵੀ ਵੀਡੀਓ ਕਾਲ 'ਤੇ ਗੱਲ ਕਰ ਸਕਦੇ ਹਾਂ ਜਾਂ ਅਸੀਂ ਉਹਨਾਂ ਦਾ ਹਾਲ ਚਾਲ ਵੀ ਪੁੱਛ ਸਕਦੇ ਹਾਂ ਤਾਂ ਜੋ ਤਾਂ ਜੋ ਕਿ ਅਸੀਂ ਮਤਲਬ ਜਲਦੀ ਤੋਂ ਜਲਦੀ ਅਗਲੇ ਬਾਰੇ ਪਤਾ ਕਰ ਸਕੀਏ ਤਾਂ ਇਹਨਾਂ ਸਾਧਨਾਂ ਦੀ ਸਾਡੀ ਅ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਲੋੜ ਹੈ ਲੋੜ ਸੀਗੀ ਅਤੇ ਉਹ ਅੱਗੇ ਲੋੜ ਰਹੂਗੀ